ਪੰਜਾਬੀ ਪਹਿਰਾਵੇ ਵਿੱਚ ਸਭ ਤੋਂ ਪਹਿਲਾਂ ਤਾਂ ਸਲਵਾਰ ਸੂਟ ਹੀ ਦੇਖਿਆ ਜਾਂਦਾ ਜਿਸਦੇ ਵਿੱਚ ਕਿ ਤਰ੍ਹਾਂ ਤਰ੍ਹਾਂ ਦੀ ਕਢਾਈ ਵਾਲੇ ਸੂਟ ਚੱਲ ਚੱਲੇ ਹੋਏ ਹਨ ਪੁਰਾਣੇ ਜ਼ਮਾਨੇ ਵਿੱਚ ਲੜਕੀਆਂ ਘਰਾਂ ਵਿੱਚ ਖੁਦ ਬੈਠ ਕੇ ਫੁਲਕਾਰੀ ਕ ਕੱਢਦੀਆਂ ਸੀ ਸੂਟ ਕੱਢਦੀਆਂ ਸਨ ਅਤੇ ਕੱਪੜੇ 'ਤੇ ਤਰ੍ਹਾਂ ਤਰ੍ਹਾਂ ਦੇ ਚਿੱਤਰ ਬਣਾਉਂਦੀਆਂ ਸਨ ਮੁੰਡੇ ਕੁੜਤਾ ਪਜਾਮਾ ਅਤੇ ਚਾਦਰੇ ਨਾਲ਼ ਗਲਾਂ ਵਿੱਚ ਕੈਂਠੇ ਪਾਏ ਹੁੰਦੇ ਸੀ ਕੁੜੀਆਂ ਪੂਰਾ ਪੰਜਾਬੀ ਪਹਿਰਾਵਾ ਪਹਿਰਾਵੇ ਦੇ ਨਾਲ਼ ਸੱਗੀ ਫੁੱਲ ਵਗੈਰਾ ਲਗਾ ਕੇ ਕਿਸੇ ਵੀ ਤ ਤਿਉਹਾਰ ਲਈ ਤਿਆਰ ਹੁੰਦੀਆਂ ਸਨ ਜਿਵੇਂ ਕਿ ਤੀਆਂ ਦਾ ਤਿਉਹਾਰ ਤੀਆਂ ਦੇ ਤਿਉਹਾਰ ਵਿੱਚ ਵੀ ਲੜਕੀਆਂ ਸੱਜ ਧੱਜ ਕੇ ਪੂਰਾ ਪੈਂਜਾ ਪੰਜਾਬੀ ਪਹਿਰਾਵਾ ਬਣਾ ਕੇ ਉਸ ਤਿਉਹਾਰ ਨੂੰ ਮਨਾਉਣ ਲਈ ਜਾਂਦੀਆਂ ਸਨ